ਤਰਨਤਾਰਨ ਜ਼ਿਲ੍ਹੇ ਵਿੱਚ ਮੁੱਖ ਵਿੱਦਿਅਕ ਅਦਾਰੇ ਵਿੱਚ ਕੁਝ ਮੁੱਖ ਸਥਾਨਾਂ ਵਿੱਚ ਜ਼ਿੰਦਗੀ ਵਿਗਿਆਨ ਸੈਂਟਰ ਤਰਨਤਾਰਨ ਜ਼ਿਲ੍ਹੇ ਦਾ ਕਿਸਾਨ ਮੇਲਾ ਅਤੇ ਤਰਨਤਾਰਨ ਜ਼ਿਲ੍ਹੇ ਦਾ ਸਵਿਜਟ ਵਿੱਦਿਅਕ ਸੰਗ੍ਰਹਿ ਸਭਾ ਹਨ ਕਾਲਜਾਂ ਯੂਨੀਵਰਸਿਟੀਆਂ ਕਿੱਤਾ ਮੁਖੀ ਸਿਖਲਾਈ ਅਤੇ ਸਕੂਲਾਂ ਦੀਆਂ ਫੀਸਾਂ ਕਾਫੀ ਜ਼ਿਆਦਾ ਹੈ ਬਹੁਤ ਜ਼ਿਆਦਾ ਫੀਸਾਂ ਹੋਣ ਕਰਕੇ ਗਰੀਬ ਗਰੀਬ ਆਦਮੀ ਲਈ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਆਮ ਆਦਮੀ ਲਈ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੈ ਫੀਸਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਖਰਚੇ ਹਨ ਜੋ ਕਿ ਇੱਕ ਗਰੀਬ ਆਦਮੀ ਲਈ ਬਹੁਤ ਮੁਸ਼ਕਿਲ ਹੈ ਕਿੱਤਾ ਮੁਖੀ ਸਿਖਲਾਈ ਸੈਂਟਰਾਂ ਵਿੱਚ ਵੀ ਗਰੀਬਾਂ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਮਸ਼ੀਨਾਂ ਦੀ ਕਮੀ ਹੋਣ ਕਰਕੇ ਅਸੀਂ ਕੋਈ ਵੀ ਕੰਮ ਆਸਾਨੀ ਨਾਲ ਨਹੀਂ ਕਰ ਸਕਦੇ ਜ਼ਿਆਦਾਤਰ ਲੋਕ ਵਿੱਚ ਸਾਹਿਤ ਵਿਗਿਆਨ ਅਤੇ ਕੰਪਿਊਟਰ ਸਾਇੰਸ ਜਿਵੇਂ ਕਿ ਬੀ ਕੌਮ ਅਤੇ ਬੀ ਕੌਮ ਹੋਨਰਸ ਨਰਸਿੰਗ ਆਈਲੈਟਸ ਇੰਗਲਿਸ਼ ਸਪੀਕਿੰਗ ਕੋਰਸਾਂ ਨੂੰ ਤਰਜੀਹ ਦਿੰਦੇ ਹਨ